ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਦੱਸਾਂਗੇ ਜੀ ਹਾਂਜੀ ਤੁਸੀਂ ਇਹ ਬੀਜਣੀਆਂ ਹੁਣ ਸ਼ੁਰੂ ਕਰਨੀਆਂ ਹੁਣ ਬੀਜ ਲਿਜਾਣਾ ਜੀ ਇਹ ਹਾਂਜੀ ਇਹ ਨਾ ਜੀ ਹੁਣ ਜਿਵੇਂ ਆਪਣੇ ਵੀ ਇਹ ਸਰਦੀ ਦੇ ਵਿੱਚ ਮਤਲਬ ਕੇ ਸਬਜ਼ੀਆਂ ਜਿਹੜੀਆਂ ਹੁਣ ਆਪਾਂ ਲਗਾਉਣੇ ਆ ਸਰਦੀ 'ਚ ਬੀਜ ਬੀਜਣੇ ਹੁੰਦੇ ਜਿਹੜਾ ਆਪਣੇ ਹੁਣ ਦੀਆਂ ਸਰਦੀ ਦੀਆਂ ਸਬਜ਼ੀਆਂ ਹੁੰਦੀਆਂ ਨੇ ਜਿਹੜੀਆਂ ਸਰਦੀ 'ਚ ਜਿਹੜੀਆਂ ਸਬਜ਼ੀਆਂ ਆਪਾਂ ਮਤਲਬ ਕੇ ਵਰਤਦੇ ਹੈ ਇਹਨਾਂ ਬਾਰੇ ਦੱਸਦੀ ਮੈਂ ਤੁਹਾਨੂੰ ਕਿ ਜਿਵੇਂ ਆਲੂ ਗੰਢੇ ਇਹ ਸਦਾ ਬਹਾਰ ਹੈ ਜੀ ਇਹਨਾਂ ਦੇ ਬੀਜ ਦੀ ਤਾਂ ਕੋਈ ਦਿੱਕਤ ਹੀ ਨਹੀਂ ਜੀ ਜਦੋਂ ਮਰਜੀ ਲੈ ਗੰਢਿਆ ਦਾ ਕਣ ਲੈ ਕੇ ਬੀਜ ਲਓ ਆਲੂਆਂ ਦਾ ਬੀਜ ਲੈ ਕੇ ਵੱਟਾਂ 'ਤੇ ਲਾ ਲਓ ਇਹ ਤਾਂ ਸਦਾ ਬਹਾਰ ਹੈ ਜੀ ਅਤੇ ਪਰ ਜਿਹੜੀ ਸਰਦੀ ਦੀਆਂ ਸਰਦੀਆਂ ਵਾਲੀਆਂ ਹੁਣ ਜਿਵੇਂ ਸਰਦੀ ਚਲੀ ਜਾਂਦੀ ਜਿਵੇਂ ਸਰਦੀ ਦੇ ਵਿੱਚ ਸਬਜ਼ੀਆਂ ਹੈ ਜਿਵੇਂ ਆਲੂ ਗੋਭੀ ਗਾ ਗਾਜਰ ਮਟਰ ਹਾਂਜੀ ਮਟਰ ਅਤੇ ਆਪਣੇ ਮੇਥੇ ਪਾਲਕ ਸਾਗ ਠੀਕ ਹੈ ਜੀ ਅਤੇ ਮੂੰਗਰੇ ਅਤੇ ਇਹ ਸਬਜ਼ੀਆਂ ਮਤਲਬ ਕਿ ਹੁਣ ਮਤਲਬ ਸਰਦੀ ਦੀਆਂ ਸਬਜ਼ੀਆਂ ਹੈਗੀਆਂ ਇਹ ਪਰ ਜਿਹੜੀਆਂ ਕੁਝ ਸਬਜ਼ੀਆਂ ਇਹੋ ਜਿਹੀਆਂ ਵੀ ਜਿਵੇਂ ਆਪਣੀਆਂ ਉਹ ਇਹ ਸਬਜ਼ੀਆਂ ਆਪਾਂ ਨੂੰ ਸਦਾ ਬਹਾਰ ਨਹੀਂ ਮਿਲਦੀਆਂ ਹੈਗੀਆਂ ਇਹ ਸਰਦੀ ਦੀਆਂ ਸਬਜ਼ੀਆਂ ਹੈਗੀਆਂ ਆਪਣੇ ਕੋਲ ਬੀਜ ਹੈਗੇ ਜੀ ਇਹਨਾਂ ਦੇ ਹਾਂਜੀ ਅਤੇ ਹੋਰ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਨਾ ਜੀ ਜਿਵੇਂ ਹੁਣ ਗਰਮੀ ਦੀਆਂ ਗਰਮੀ ਵਿੱਚ ਆਪਾਂ ਮਤਲਬ ਜਿਹੜੀਆਂ ਸਬਜ਼ੀਆਂ ਚਾਹੀਦੀਆਂ ਆਪਾਂ ਨੂੰ ਉਹਨਾਂ ਦੀਆਂ ਵੱਲਾਂ ਲਾਈਆਂ ਜਾਂਦੀਆਂ ਜਿਵੇਂ ਕੱਦੂ ਤੋਰੀਆਂ ਟਿੰਡੋ ਭਿੰਡੀਆਂ ਫਲੀਆਂ ਗੁਆਰੇ ਦੀਆਂ ਦੇਸੀ ਗੁਆਰਾ ਅਤੇ ਇੱਕ ਆਪਣਾ ਹੋਰ ਲੰਬੀਆਂ ਜਿਹੀਆਂ ਹਰੇ ਦੀਆਂ ਲੰਬੀਆਂ ਫਲੀਆਂ ਵਾਲਾ ਗੁਆਰਾ ਹੁੰਦਾ ਹੈ ਠੀਕ ਹੈ ਜੀ ਅਤੇ ਟਿੰਡੇ ਵੀ ਟਿੰਡੇ ਤਾਂ ਹੁਣ ਸਰਦੀ 'ਚ ਵੀ ਆਏ ਪਏ ਹੈਗੇ ਹੈ ਵੈਸੇ ਤਾਂ ਪਰ ਇਹ ਹੁਣ ਤਾਂ ਸਬਜ਼ੀਆਂ ਏ ਪਰ ਖ਼ਾਸ ਕਰਕੇ ਇਹ ਸਬਜ਼ੀਆਂ ਗਰਮੀ ਦੀਆਂ ਹੈਗੀਆਂ ਕੱਦੂ ਤੋਰੀਆਂ ਭਿੰਡੀਆਂ ਫਲੀਆਂ ਗੁਆਰਾ ਠੀਕ ਹੈ ਜੀ ਹਾਂਜੀ ਅਤੇ ਇਹ ਸਬਜ਼ੀਆਂ ਮਤਲਬ ਆਪਾਂ ਨੂੰ ਨਾ ਮਤਲਬ ਕਈ ਗਰਮੀ ਦੀਆਂ ਹੈਗੀਆਂ ਸਰਦੀ ਦੀਆਂ ਸਬਜ਼ੀਆਂ ਆਪਣੇ ਕਰਕੇ ਗਾਜਰਾਂ ਪਾਲਕ ਗੋਭੀ ਮਟਰ ਮੇਥੇ ਇਹ ਸਬਜ਼ੀਆਂ ਆਪਣੀਆਂ ਮਤਲਬ ਕਿ ਇਹ ਸਰਦੀ ਦੀਆਂ ਸਬਜ਼ੀਆਂ ਹੈਗੀਆਂ ਅਤੇ ਇਹਨਾਂ ਨੂੰ ਲਾਇਆ ਜਾ ਸਕਦਾ ਹੈਗਾ ਹੋਰ ਕੋਈ ਗੱਲਬਾਤ ਹਾਂਜੀ ਹਾਂਜੀ ਹਾਂਜੀ ਇਹਨਾਂ ਨੂੰ ਸਾਂਭ ਸੰਭਾਲ ਵਾਸਤੇ ਜੀ ਹਾਂਜੀ ਇਹਨਾਂ ਨੂੰ ਵੇਖੋ ਨਾ ਜੀ ਜਿਹੜੀ ਵੀ ਆਪਾਂ ਭਵਾਂ ਗਰਮੀ ਦੀ ਹੋਵੇ ਸਬਜ਼ੀ ਭਵਾਂ ਸਰਦੀ ਦੀ ਹੋਵੇ ਸਭ ਤੋਂ ਪਹਿਲਾਂ ਤਾਂ ਆਪਾਂ ਮਤਲਬ ਜਿਹੜੀ ਇੱਕ ਆਪਣੀ ਖੇਤੀ ਹੈ ਨਾ ਵਾਹਣ ਵਾਲਾ ਖੇਤ ਹੁੰਦਾ ਜਿਹੜਾ ਆਪਣਾ ਉਹਨੂੰ ਚੰਗੀ ਤਰ੍ਹਾਂ ਮਤਲਬ ਕਿ ਮਤਲਬ ਕੇ ਵਾਹ ਬੀਜ ਕੇ ਨਾ ਮਤਲਬ ਚੰਗੀ ਤਰ੍ਹਾਂ ਵਾਹ ਕੇ ਸਵਾਰ ਕੇ ਸਫਾਈ ਕਰਕੇ ਉਹਦੇ 'ਚ ਜਿਹੜੀ ਖਾਦ ਪਾਉਣੀ ਨਾ ਆਪਾਂ ਰੂੜੀ ਦੀ ਖਾਦ ਪਾ ਦੇਈਏ ਰੂੜੀ ਦੀ ਖਾਦ ਪਾ ਦਈਏ ਨਾ ਹਾਂਜੀ ਰੂੜੀ ਦੀ ਖੇਦ ਖਾਦ ਸਾਰਿਆਂ ਤੋਂ ਬੈਸਟ ਹੈਗੀ ਹੈ ਔਰਗੈਨਿਕ ਖਾਦ ਵੀ ਇੱਕ ਤਿਆਰ ਕੀਤੀ ਜਾਂਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਔਰਗੈਨਿਕ ਖੇ ਖਾਦ ਤਿਆਰ ਕੀਤੀ ਜਾਂਦੀ ਹੈ ਉਹ ਪਾਈ ਜਾਵੇ ਤਾਂ ਸਬਜ਼ੀਆਂ ਹੋਰ ਵੀ ਬੈਸਟ ਹੋ ਜਾਂਦੀਆਂ ਬਾਕੀ ਹਰੀਆਂ ਮਿਰਚਾਂ ਨਿੰਬੂ ਵਗੈਰਾ ਇਹ ਸਦਾ ਬਹਾਰ ਹੀ ਰਹਿੰਦੀਆਂ ਠੀਕ ਹੈ ਜੀ ਅਤੇ ਕੋਈ ਗੱਲ ਨੀ ਤੁਸੀਂ ਦੁਕਾਨ 'ਤੇ ਆ ਜਾਇਓ ਜੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਆਂਗੇ ਬੀਜ ਵੀ ਵਧੀਆ ਕੁਆਲਿਟੀ ਦੇ ਦਿਆਂਗੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ